ਗਾਇਕ ਆਮ ਕਰਕੇ ਮਤਲਬ ਵਾਰ ਵਾਰ ਸੇਹਰਾ ਲਾਣਾ ਸਾਹ ਲੈਣਾ ਜਾਂ ਅਵਾਜ ਉੱਚੀ ਕਰ ਲੈਣਾ ਕਦੇ ਬਹੁਤ ਧੀਮੀ ਕਰ ਲੈਣਾ ਰਾਗ ਵਿੱਚ ਨਾ ਰਹਿਣਾ ਜਾਂ ਉਨ੍ਹਾਂ ਦੇ ਆਤਮ ਵਿਸ਼ਵਾਸ ਦੀ ਘਾਟ ਹੋਣਾ ਕੋਈ ਕੋਈ ਗਾਇਕ ਬੋਲਦੇ ਬੋਲਦੇ ਘਬਰਾਹਟ ਦੇ ਕਾਰਨ ਬਾਹਰ ਜ਼ੋਰ ਜ਼ੋਰ ਦੀ ਹੱਥ ਹਿਲਾਉਣਾ ਪੂਰੀ ਆਤਮ ਵਿਸ਼ਵਾਸ ਵਿੱਚ ਨਾ ਰਹਿਣਾ ਇਨ੍ਹਾਂ ਤੋਂ ਬਚਣ ਲਈ ਗਾਇਕਾਂ ਨੂੰ ਵਾਰ ਵਾਰ ਰਿਆਜ਼ ਕਰਨਾ ਚਾਹੀਦਾ ਹੈ ਬ ਗਾਇਕਾਂ ਨੂੰ ਵੇਖਣਾ ਚਾਹੀਦਾ ਵੀ ਸਾਡੀਆਂ ਕੀ ਗਲਤੀਆਂ ਨੇ ਅਤੇ ਓਨੂੰ ਉਨ੍ਹਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ